ਅੱਜ ਦੀਆਂ ਬਦਲਦੀਆਂ ਤਕਨੀਕੀ ਤਰੱਕੀਆਂ ਨਾਲ ਜੁੜੇ ਰਹਿਣ ਲਈ ਸਾਨੂੰ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਤਿਆਰ ਰਹਿਣਾ ਚਾਹੀਦਾ ਹੈ ਅੱਜ ਦੇ ਸਮਾਜ ਵਿੱਚ ਤਕਨੀਕੀ ਤਰੱਕੀਆਂ ਦੀ ਬਹੁਤ ਜਿਆਦਾ ਲੋੜ ਹੈ ਅੱਜ ਦੇ ਇਹਨਾਂ ਤਕਨੀਕੀ ਤਰੱਕੀਆਂ ਕਰਕੇ ਹੀ ਸਾਡਾ ਸਮਾਂ ਇਨਸਾਨ ਦਾ ਸਮਾਂ ਬਹੁਤ ਜਿਆਦਾ ਬਚਣ ਲੱਗ ਗਿਆ ਹੈ ਮੈਂ ਮੋਬਾਇਲ ਕੰਪਿਊਟਰ ਘਰੇ ਹੀ ਸਿੱਖਿਆ ਸੀ ਕਿਉਂਕਿ ਅੱਜ ਦੇ ਸਮਾਜ ਵਿੱਚ ਇਹ ਇੱਕ ਮੁੱਖ ਲੋੜ ਹੈ ਹਰ ਕੰਮ ਤਕਨੀਕੀ ਤਕਨੀ ਤਕਨੀਕ ਨਾਲ਼ ਹੀ ਕੀਤਾ ਜਾਂਦਾ ਹੈ ਇਸ ਨਾਲ਼ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਸਾਨੂੰ ਜਿਆਦਾ ਜੱਦੋ ਜਹਿਦ ਨਹੀਂ ਕਰਨੀ ਪੈਂਦੀ ਸਾਡਾ ਸਮਾਂ ਵੀ ਬਹੁਤ ਬਚਦਾ ਹੈ ਸਾਨੂੰ ਬੈਂਕ ਵਿੱਚ ਜਾ ਕਿਤੇ ਵੀ ਜਾਣ ਦੀ ਲੋੜ ਨਹੀਂ ਅਸੀਂ ਘਰ ਬੈਠੇ ਔਨਲਾਈਨ ਹੀ ਸਭ ਕੁਛ ਕਰ ਸਕਦੇ ਹਾਂ ਸਾਨੂੰ ਕਿਤੇ ਵੀ ਮੋਲਾਂ ਵਿੱਚ ਜਾਂ ਦੁਕਾਨਾਂ ਵਿੱਚ ਜਾਣ ਦੀ ਲੋੜ ਨਹੀਂ ਜੋ ਵੀ ਸਾਨੂੰ ਚਾਹੀਦਾ ਅਸੀਂ ਘਰ ਬੈਠੇ ਹੀ ਮੰਗਵਾ ਸਕਦੇ ਹਾਂ ਇਸ ਕਰਕੇ ਬਦਲ ਰਹੀਆਂ ਤਕਨੀਕਾਂ ਦਾ ਸਾਡੇ ਭਵਿੱਖ ਵਿੱਚ ਬਹੁਤ ਜਿਆਦਾ ਬਹੁਤ ਜਿਆਦਾ ਲਾਭ ਹੈ